ਹੈਲੋ ਵੀਰੇ ਓਮ ਸਾਈਂ ਮੋਬਾਇਲ ਉਹ ਤੋਂ ਸ਼ੋਪ ਤੋਂ ਬੋਲਦੇ ਹੋ ਉਹ ਆਪਾਂ ਆਪਾਂ ਮੋਬਾਇਲ ਲੈਣਾ ਸੀ ਵੀਰੇ ਆਪਾਂ ਲੈਣਾ ਜੀ ਆਈਫੌਨ ਐਕਸਰ ਜਾਂ ਉਹਦੇ ਉੱਤੇ ਵਾਲੀ ਮਤਲਬ ਸੀਰੀਜ

ਅੱਛਾ ਜੀ ਅੱਛਾ ਜੀ ਅੱਛਾ ਜੀ ਆਪਾਂ ਡਾਊਨ ਪੇਮੈਂਟ ਕਰਾਂਗੇ ਜੀ ਬਾਕੀ ਆਪਾਂ ਕਿਸ਼ਤਾਂ ਕਰ ਲਵਾਂਗੇ

ਆਪਾਂ ਕਰਾਂਗੇ ਜੀ ਦਸ ਕੁ ਹਜ਼ਾਰ ਹਾਂਜੀ ਦਸ ਹਜ਼ਾਰ ਕਿਸ਼ਤਾਂ ਹਾਂ ਦਸ ਹਜ਼ਾਰ ਕਰਕੇ ਆਪਾਂ ਕਿਸ਼ਤਾ ਕਰਨੀਆਂ ਨੇ ਲੋਨ ਕਰਾ ਲਵਾਂਗੇ

ਹਾਂਜੀ ਬਾਕੀ ਕੰਡੀਸ਼ਨ ਕਿਆ ਹੈ ਜੇ ਵੀਰੇ ਆਪਾਂ ਜਿਹੜਾ ਸੈਕਿੰਡ ਹੈਂਡ ਲੈ ਸਕਦੇ ਹਾਂ ਹਾਂ ਜੀ ਅੱਛਾ ਜੀ ਅੱਛਾ ਜੀ

ਹਾਂਜੀ ਹਾਂ ਹਾਂ ਜੀ ਨਾਲੇ ਆਪਾਂ ਨਾਲੇ ਜੀ ਆਪਾਂ ਵੀਵੋ ਔਪੋ ਦਾ ਵੀ ਲੈਣਾ ਤੀ ਵੀਰੇ ਕੋਈ ਵਧੀਆ ਜਿਹਾ ਫੂ ਫੋਨ ਅੱਛਾ ਜੀ ਮਤਲਬ ਇਹਨਾਂ ਦਾ ਜੀ ਆਪਾਂ ਜੀ ਨਵਾਂ ਹੀ ਲੈਣਾ ਜੀ ਇਹ ਆਪਾਂ ਨਵਾਂ ਹੀ ਲਵਾਂਗੇ ਮਤਲਬ ਵੀਵੋ ਓਪੋ ਵਾਲਾ ਅਸੀਂ ਆਪਾਂ ਕਰ ਹੀ ਦੇਣਾ ਜੀ ਇਹ ਆਪਾਂ ਨੇ ਬਸ ਬ ਵਧੀਆ ਹੋਣਾ ਚਾਹੀਦਾ ਰੈ ਰੈਮ ਰੂਮ ਮ ਪ ਆਪਾਂ ਕਿੰਨੀ ਕੁ ਹੈ ਇਹਨਾਂ ਦੀ ਅੱਛਾ ਜੀ ਠੀਕ ਹੈ ਜੀ

ਬਾਕੀ ਚਾ ਚਾਰਜਰ ਵਗੈਰਾ ਤਾਂ ਨਾਲੇ ਦਿਉਂਗੇ ਹਾਂ ਜੀ ਅੱਛਾ ਜੀ ਬਾਕੀ ਆਹ ਤੁਸੀਂ ਆਪਣੀ ਸ਼ੋਪ ਦਾ ਉਹ ਕਰ ਦਿਓ ਹੈ ਵਟਸਐਪ ਐਡਰੈਸ ਮੈਨੂੰ ਠੀਕ ਹੈ ਜੀ ਠੀਕ ਹੈ ਚੰਗਾ ਚੰਗਾ ਜੀ